ਮੈਂ ਪੀ ਐਮ ਕੇ ਵੀ ਬਾਈ ਸਿਖਲਾਈ ਸ਼ੈਕਸ਼ਨ ਵਿੱਚ ਦਾਖਲਾ ਲਿਆ ਹੈ ਪਰ ਮੈਨੂੰ ਹਾਲੇ ਸੋਮਾਂ ਸਾਰ ਨਾਲ ਕੁਛ ਵੀ ਨਹੀਂ ਪਤਾ ਮੈਨੂੰ ਸਿਖਲਾਈ ਸਿੱਖਣੀ ਬਹੁਤ ਵਧੀਆ ਲੱਗਦੀ ਹੈ ਸਿਖਲਾਈ ਸ਼ੈਕਸ਼ਨ ਵਿੱਚ ਦਾਖਲਾ ਹੋਣ ਦੀ ਸਥਿਤੀ ਨੂੰ ਮੈਂ ਸਾਂਝਾ ਕਰਨਾ ਚਾਹੁੰਦੀ ਹਾਂ ਅਤੇ ਇਸ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਦੀ ਮੰਗ ਅਤੇ ਅਨੁਸੂਚੀ ਦੀ ਜ਼ਰੂਰਤ ਨੂੰ ਪੂਰਾ ਕਰਦੀ ਹਾਂ ਅਤੇ ਮੈਨੂੰ ਸਿਖਲਾਈ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਪਹਿਲਾਂ ਮੈਂ ਕਿਸੇ ਦੇ ਘਰ ਸਿਖਲਾਈ ਸਿੱਖਣ ਜਾਂਦੀ ਹੁੰਦੀ ਸੀ ਅਤੇ ਉੱਥੋਂ ਮੈਨੂੰ ਕੁਝ ਜ਼ਿਆਦਾ ਕੁਝ ਮਿਲਿਆ ਨਹੀਂ ਪ੍ਰਾਪਤ ਨਹੀਂ ਹੋਇਆ ਅਤੇ ਮੈਨੂੰ ਮੈਂ ਆਪਣੇ ਇਸ